ਹੈਲੋ ਮੇਰੇ ਪਰਿਵਾਰ ਦੇ ਮੈਂਬਰ ਦਾ ਮੌਤ ਰਜਿਸਟਰੇਸ਼ਨ ਫੋਰਮ ਗਲਤ ਸਥਾਨ ਦੇ ਨਾਲ ਜਮ੍ਹਾਂ ਕੀਤਾ ਗਿਆ ਸੀ ਉਹਨਾਂ ਦੀ ਮੌਤ ਦਾ ਸਥਾਨ ਅਸਲ ਵਿੱਚ ਫਾਜ਼ਿਲਕਾ ਹੈ ਪਰ ਰਜਿਸਟਰੇਸ਼ਨ ਫੋਰਮ 'ਤੇ ਉਹਨਾਂ ਦੀ ਮੌਤ ਦਾ ਸਥਾਨ ਫਿਰੋਜ਼ਪੁਰ ਆਇਆ ਹੈ ਕਿਰਪਾ ਕਰਕੇ ਇਸ ਰਿਕਾਰਡ ਨੂੰ ਅਪਡੇਟ ਕੀਤਾ ਜਾਵੇ ਇਸ ਅਪਡੇਟ ਦੇ ਲਈ ਮੈਂ ਸਹਾਇਕ ਦਸਤਾਵੇਜ਼ ਪ੍ਰਦਾਨ ਕਰਦੀ ਹਾਂ